ਹਾਂ ਪੰਜਾਬ ਵਿੱਚ ਸਿਹਤ ਸੰਭਾਲ ਅ ਕਰਨ ਲਈ ਬਹੁਤ ਪਹਿਲਕਦਮੀਆਂ ਹਨ ਜਿਵੇਂ ਕਿ ਕਬੱਡੀ ਦੇ ਕੈਂਪ ਲਗਾਏ ਜਾਂਦੇ ਹਨ ਜੋ ਕਿ ਪੰਜਾਬ ਦੇ ਵਿੱਚ ਆਮ ਹੀ ਖੇਡੀ ਜਾਂਦੀ ਹੈ ਔਰ ਉਸ ਤੋਂ ਬਿਨਾਂ ਕੁਸ਼ਤੀ ਦੇ ਅਖਾੜੇ ਲਗਾਏ ਜਾਂਦੇ ਹਨ ਔਰ ਇਸਦੇ ਵਿੱਚ ਵੀ ਅਲੱਗ ਅਲੱਗ ਪ੍ਰਕਾਰ ਦੇ ਅਖਾੜੇ ਹੁੰਦੇ ਹਨ ਜਿਸ ਦੇ ਵਿੱਚ ਜਵਾਨਾਂ ਨੂੰ ਬਾਅਦ ਵਿੱਚ ਕੋਪੀਟੀਸ਼ਨ ਕਰਵਾਏ ਜਾਂਦੇ ਹਨ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਹਨ ਅਤੇ ਉਸਦੇ ਨਾਲ ਜਵਾਨਾਂ ਦਾ ਮਨੋਬਲ ਉੱਚਾ ਹੁੰਦਾ ਹੈ